ਡਰਾਇੰਗ ਸਮੱਗਰੀ ਦੇ ਵਿੱਚ ਪੈਨਸਲ ਰੇਜ਼ਰ ਸ਼ਾਰਪਨਰ ਸਕੇਲ ਬਰੱਸ਼ ਕਲਰ ਸਕੈਚ ਕਲਰ ਡਰਾਇੰਗ ਕਲਰ ਮੈਨੂੰ ਇਹ ਸਭ ਬਹੁਤ ਵਧੀਆ ਲੱਗਦੇ ਹਨ ਪੈਨਸਲ ਸਕੇਲ ਰੇਜ਼ਰ ਤੋਂ ਬਿਨ੍ਹਾਂ ਅਸੀਂ ਕੋਈ ਵੀ ਡਰਾਇੰਗ ਨਹੀਂ ਬਣਾ ਸਕਦੇ ਸਿੰਪਲ ਡਰਾਇੰਗ ਦੇ ਲਈ ਸਕੈਚ ਕਲਰ ਵਰਤਦੇ ਵਰਤੇ ਜਾਂਦੇ ਹਨ ਵਾਟਰ ਕਲਰ ਵੀ ਡਰਾਇੰਗ ਦੇ ਵਿੱਚ ਯੂਜ਼ ਹੁੰਦੇ ਹਨ ਇਸ ਤੋਂ ਇਲਾਵਾ ਕੋਈ ਫੋਟੋ ਬਣਾਉਣੀ ਹੋਵੇ ਤਾਂ ਅਸੀਂ ਪੇਂਟਿੰਗ ਦੇ ਲਈ ਪੇਂਟ ਕਲਰ ਯੂਜ਼ ਕਰਦੇ ਹਾਂ ਇਹਨਾਂ ਸਭ ਦੀ ਵਰਤੋਂ ਨਾਲ ਡਰਾਇੰਗ ਬਹੁਤ ਚੰਗੀ ਤਰ੍ਹਾਂ ਉੱਭਰ ਕੇ ਆਉਂਦੀ ਹੈ ਅਤੇ ਦੇਖਣ ਵਿੱਚ ਬਹੁਤ ਹੀ ਜ਼ਿਆਦਾ ਸੋਹਣੀ ਲੱਗਦੀ ਹੈ